ਮੈਨੂੰ ਚਿੱਤਰਕਾਰੀ ਦਾ ਸ਼ੌਂਕ ਪੰਜਵੀਂ ਜਮਾਤ ਤੋਂ ਪਿਆ ਸੀ ਅਤੇ ਉਦੋਂ ਹੀ ਮੈਂ ਆਪਣੀ ਟੀਚਰ ਤੋਂ ਬਹੁਤ ਹੀ ਕੁੱਛ ਸਿੱਖਣਾ ਚਾਲੂ ਕਰ ਦਿੱਤਾ ਸੀ ਮੇਰੇ ਜੋ ਵੀ ਡਰਾਇੰਗ ਦੇ ਟੀਚਰ ਸਨ ਉਹ ਸਾਨੂੰ ਬਹੁਤ ਹੀ ਪ੍ਰੇਰਨਾ ਦਿੰਦੇ ਸਨ ਅਤੇ ਵਧੀਆ ਟ੍ਰਿਕਸ ਦੱਸਦੇ ਰਹਿੰਦੇ ਸਨ ਅਤੇ ਜਿਵੇਂ ਹੀ ਮੈਂ ਅਗਲੀ ਅਗਲੀ ਜਮਾਤ ਵਿੱਚ ਹੁੰਦੀ ਗਈ ਓਦਾਂ ਹੀ ਮੇਰਾ ਹੱਥ ਸਾਫ਼ ਹੁੰਦਾ ਗਿਆ ਅਤੇ ਜਿਵੇਂ ਹੀ ਮੈਂ ਬਾਰਵੀਂ ਕਲਾਸ ਵਿੱਚ ਪਹੁੰਚੀ ਤਾਂ ਓਦੋਂ ਮੈਂ ਸਟੇਟ ਲੈਵਲ ਡਿਸਟ੍ਰਿਕਟ ਲੈਵਲ 'ਤੇ ਪਿੰਡ ਦੇ ਲੈਵਲ 'ਤੇ ਡਰਾਇੰਗ ਦੇ ਵਿੱਚ ਚਿੱਤਰਕਾਰੀ ਕਰਕੇ ਮੈਂ ਜਿੱਤ ਹਾਸਿਲ ਕੀਤੀ ਸੀ ਅਤੇ ਉਸ ਤੋਂ ਬਾਅਦ ਕੋਲੇਜ ਟਾਈਮ ਦੇ ਵਿੱਚ ਕੋਈ ਵੀ ਫੈਸਟੀਵਲ ਹੁੰਦਾ ਸੀ ਜਿਵੇਂ ਯੂਥ ਫੈਸਟੀਵਲ ਹੁੰਦਾ ਸੀ ਜਾਂ ਕੋਈ ਹੋਰ ਤਾਂ ਉਦੋਂ ਵੀ ਮੈਂ ਆਪਣੀ ਚਿੱਤਰਕਾਰੀ ਨੂੰ ਪੇਸ਼ ਕਰਦੀ ਸੀ ਅਤੇ ਉੱਥੇ ਵੀ ਬਹੁਤ ਹੀ ਸਨਮਾਨਿਤ ਸਨਮਾਨਿਤ ਹੁੰਦੀ ਸੀ ਅਤੇ ਉਸੇ ਤਰ੍ਹਾਂ ਹੀ ਹੁਨ ਮੈਂ ਇਸਨੂੰ ਆਪਣਾ ਕਾਰੋਬਾਰ ਬਣਾਇਆ ਹੈ ਅਤੇ ਲੋਕ ਇਸ ਮੈਨੂੰ ਇੱਕ ਪੇਸ਼ੇ ਵਜੋਂ ਵੀ ਜਾਣਦੇ ਹਨ ਲੋਕ ਇਸ ਦੇ ਮੈਨੂੰ ਪੈਸੇ ਵੀ ਦਿੰਦੇ ਹਨ ਅਤੇ ਮੈਂ ਯੂਟੀਊਬ ਤੋਂ ਦੇਖ ਕੇ ਕੁੱਛ ਨਾ ਕੁੱਛ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਅਤੇ ਇਸ ਨਾਲ਼ ਮੈਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਮਿਲਦੀ ਹੈ